ਹੈਲੋ ਤੁਸੀਂ ਅਲਵਿੰਨ ਪੀਜ਼ਾ ਤੋਂ ਬੋਲ ਰਹੇ ਹੋ ਮੈਂ ਅੱਧੇ ਘੰਟੇ ਤੋਂ ਪੀਜ਼ਾ ਆਰਡਰ ਕੀਤਾ ਸੀ ਪਰ ਉਹ ਹੁਣ ਤੱਕ ਆਇਆ ਨਹੀਂ ਹੈ ਕੀ ਤੁਸੀਂ ਪੁੱਛ ਸਕਦੇ ਹੋ ਕਿ ਅਲਵਿੰਨ ਪੀਜ਼ਾ ਤੋਂ ਹੁਣ ਤੱਕ ਆਰਡਰ ਕਿਉਂ ਨਹੀਂ ਆਇਆ ਹੈ ਅਤੇ ਡਿਲੀਵਰੀ ਵਾਲਾ ਮੇਰਾ ਫੋਨ ਵੀ ਨਹੀਂ ਚੱਕ ਰਿਹਾ ਸਰ ਤੁਸੀਂ ਪਲੀਜ਼ ਉਹਨੂੰ ਕੰਟੈਕਟ ਕਰਕੇ ਪੁੱਛੋ ਕਿ ਉਹ ਕਦੋਂ ਤੱਕ ਆਵੇਗਾ ਕਿਉਂਕਿ ਮੈਨੂੰ ਭੁੱਖ ਵੀ ਬਹੁਤ ਲੱਗੀ ਹੋਈ ਹੈ ਅਤੇ ਮੈਂ ਵੇਟ ਕਰਦੀ ਕਰਦੀ ਥੱਕ ਗਈ ਹਾਂ ਤੁਸੀਂ ਪਲੀਜ਼ ਡਿਲੀਵਰੀ ਪਾਰਟਨਰ ਨੂੰ ਕਾਲ ਕਰਕੇ ਕੇ ਪੁੱਛੋ ਕਿ ਉਹ ਕਦੋਂ ਆਵੇਗਾ